ਖੇਡਾਂ ਦੇ ਨਾ ਵਿੱਚ ਕਈ ਵਾਰੀ ਹਿੰਸਾ ਵੀ ਹੋ ਜਾਂਦੀ ਹੈ ਖੇਡ ਖੇਤਰ ਵਿੱਚ ਕਈ ਵਾਰੀ ਖੇਡਦੇ ਖੇਡਦੇ ਬੱਚੇ ਲੜ ਪੈਂਦੇ ਹਨ ਜਾਂ ਫਿਰ ਕੋਈ ਬਹੁਤ ਜ਼ਿਆਦਾ ਹਿੰਸਾ ਦਾ ਕ ਕਾਰਨ ਬਣ ਜਾਂਦੇ ਹਨ ਖੇਡ ਖੇਤਰ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਬੱਤ ਹਮੇਸ਼ਾ ਹੀ ਹੀ ਖੇਡਾਂ ਦਾ ਦੌਰ ਬਣਿਆ ਰਹਿੰਦਾ ਹੈ ਖੇਡਾਂ ਦਾ ਦੀ ਖੇਡ ਖੇਤਰ ਵਿੱਚ ਸਾਨੂੰ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨਾਲ ਬੰਦੇ ਦੀ ਫਿਜੀਕਲ ਫਿਟਨੈਸ ਵੱਧਦੀ ਹੈ ਇਹ ਖੇਡ ਨੂੰ ਹਮੇਸ਼ਾ ਖੇਡ ਸਮਝ ਕੇ ਹੀ ਖੇਡਣਾ ਚਾਹੀਦਾ ਹੈ ਨਾ ਕਿ ਇਸ ਨੂੰ ਜਿੱਤ ਹਾਰ ਦਾ ਇੱਕ ਟੀਚਾ ਬਣਾਉਣਾ ਚਾਹੀਦਾ ਹੈ ਖੇਡ ਪ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਹੈ ਕਿ ਖੇਡ ਕਿਰਿਆ ਵਿੱਚ ਹਮੇਸ਼ਾ ਆਪਣੇ ਡਿਸਿਪਲਨ ਦੇ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਡਿਸਿਪਲਨ ਨਾਲ ਹੀ ਖੇਡ ਨੂੰ ਸਹੀ ਤਰੀਕੇ ਨਾਲ ਖੇਡਿਆ ਜਾ ਸਕਦਾ ਹੈ ਡਸਿਪਲਨ ਤੋਂ ਬਿਨਾ ਕੋਈ ਵੀ ਖੇਡ ਨੂੰ ਤੁਸੀਂ ਨਹੀਂ ਖੇਡ ਸਕਦੇ ਜੇ ਤੁਸੀਂ ਜਿੱਤ ਨੂੰ ਅਪ ਟੀਚਾ ਮੰਨ ਕੇ ਖੇਡੋਗੇ ਤਾਂ ਤੁਸੀਂ ਹਮੇਸ਼ਾ ਨਿਰਾਸ਼ ਹੀ ਹੋਵੋਗੇ ਸੋ ਖੇਡ ਦੇ ਵਿੱਚ ਖੇ ਖੇਡ ਦੇ ਵਿੱਚ ਹੀ ਖੇਡਣਾ ਚਾਹੀਂ ਨੂੰ ਖੇਡ ਖੇਤਰ ਵਿੱਚ ਹੀ ਸਹੀ ਖੇਡਣਾ ਚਾਹੀਦਾ ਹੈ ਧੰਨਵਾਦ